ਹਾਂ ਮੈਂ ਸੋਚਦੀ ਹਾਂ ਕਿ ਮੀਡੀਆ ਅਤੇ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਨੂੰ ਉਚਿੱਤ ਰੂਪ ਵਿੱਚ ਦਰਸਾਇਆ ਗਿਆ ਹੈ ਪੰਜਾਬੀ ਭਾਸ਼ਾ ਪੰਜਾਬ ਦੀ ਮੁੱਖ ਬੋਲੀ ਹੈ ਕੋਸ਼ ਵਿੱਚ ਅਲੱਗ ਅਲੱਗ ਸ਼ਬਦਾਂ ਦੀ ਗਿਣਤੀ ਇੱਕ ਸੱਤ ਜੀਰੋ ਸੱਤ ਇੱਕ ਚਾਰ ਹੈ ਪਹਿਲੇ ਪੰਜ ਸਭ ਤੋਂ ਵੱਧ ਆਮ ਪੰਜਾਬੀ ਪਾਰਟ ਦਾ ਦਸ ਪ੍ਰਸੈਂਟ ਕਵਰ ਕਰਦੇ ਨੇ ਮੀਡੀਏ ਵਿੱਚ ਵੀ ਪੰਜਾਬੀ ਨੂੰ ਬੋਲਿਆ ਜਾਂਦਾ ਹੈ ਜਿਵੇਂ ਬਹੁਤ ਸਾਰੇ ਚੈਨਲਾਂ 'ਤੇ ਪੰਜਾਬੀ ਵਿੱਚ ਹੀ ਖਬਰਾਂ ਆਉਂਦੀਆਂ ਨੇ ਅਤੇ ਬਹੁਤ ਸਾਰੀ ਮੀਡੀਆ ਵਾਲੇ ਪੰਜਾਬੀ ਵਿੱਚ ਹੀ ਨਵੀਆਂ ਨਵੀਆਂ ਖਬਰਾਂ ਦੱਸਦੇ ਨੇ ਇਹ ਤਾਂ ਸਾਨੁੂੰ ਆਲੇ ਦੁਆਲੇ ਤੋਂ ਜਾਣੂ ਕਰਵਾਉਂਦੇ ਨੇ ਪੰਜਾਬੀ ਭਾਸ਼ਾ ਸਿੱਖਿਆ ਪ੍ਰਣਾਲੀ ਵਿੱਚ ਵੀ ਵਰਤੀ ਜਾਂਦੀ ਹੈ ਜਿਵੇਂ ਅੱਜ ਕੱਲ੍ਹ ਹਰ ਇੱਕ ਜਮਾਤ ਵਿੱਚ ਪੰਜਾਬੀ ਵਿਸ਼ਾ ਹੁੰਦਾ ਹੀ ਹੈ ਅਤੇ ਹਰ ਇੱਕ ਬੱਚੇ ਨੂੰ ਪੰਜਾਬੀ ਅ ਪੜ੍ਹਾਈ ਜਾਂਦੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਸਾਨੂੰ ਪੰਜਾਬੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਪੰਜਾਬ ਵਿੱਚ ਤਾਂ ਆਮ ਤੌਰ 'ਤੇ ਪੰਜਾਬੀ ਹੀ ਬੋਲੀ ਜਾਂਦੀ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹਨ ਜਿੱਥੇ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਸਿੱਖਿਆ ਪ੍ਰਣਾਲੀ ਦੇ ਵਿੱਚ ਪੰਜਾਬ ਸਿੱਖਿਆ ਪ੍ਰਣਾਲੀ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਉੱਚਿਤ ਰੂਪ ਵਿੱਚ ਦਰਸਾਇਆ ਗਿਆ ਹੈ ਅਤੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ